ਕੁਝ ਦਿਨ ਪਹਿਲਾਂ ਮੈਂ ਕਾਲਜ ਵੱਲੋਂ ਚੰਡੀਗੜ੍ਹ ਤੇ ਇੱਕ ਕੈਂਪ ਲਾਉਣ ਗਈ ਸੀ ਜਿੱਥੇ ਮੇਰਾ ਖਾਣ ਪੀਣ ਦਾ ਸਾਰਾ ਖਰਚਾ ਕਾਲਜ ਨੇ ਹੀ ਦੇਣਾ ਸੀ ਉੱਥੇ ਮੈਂ ਇੱਕ ਵਧੀਆ ਜਿਹੇ ਰੈਸਟੋਰੈਂਟ ਵਿੱਚ ਜਾ ਕੇ ਦੋ ਬਰਗਰ ਇੱਕ ਪੀਜ਼ਾ ਇੱਕ ਫਰੈਂਚ ਫਰਾਈਸ ਅਤੇ ਇੱਕ ਕੋਲਡ ਡਰਿੰਕ ਦੀ ਬੋਟਲ ਓਡਰ ਕੀਤੀ ਜਿਸ ਦੀ ਮੇਰੇ ਕੋਲ ਕੋਈ ਰਸੀਦ ਨਹੀਂ ਹੈ ਉਹ ਰਸੀਦ ਮੈਂ ਆਪਣੇ ਕਾਲਜ ਵਿੱਚ ਦੇਣੀ ਹੈ ਤਾਂ ਰਸੀਦ ਲਈ ਮੈਂ ਉਸ ਰੈਸਟੋਰੈਂਟ ਦੀ ਵੈੱਬਸਾਈਟ 'ਤੇ ਗਈ ਅਤੇ ਉੱਥੇ ਓਡਰ ਇਤਿਹਾਸ ਵਿੱਚ ਜਾ ਕੇ ਮੈਂ ਆਪਣੀ ਰਸੀਦ ਦੀ ਕਾਪੀ ਡਾਊਨਲੋਡ ਕੀਤੀ ਅਤੇ ਆਪਣੇ ਕੋਲੇਜ ਵਿੱਚ ਜਮ੍ਹਾਂ ਕਰਵਾ ਦਿੱਤੀ